ਹਾਂ ਸਾਡਾ ਖੇਤਰ ਰਾਜਵੰਸ਼ਾਂ ਅਤੇ ਸ਼ਾਸਕਾਂ ਦੁਆਰਾ ਪ੍ਰਭਾਵਿਤ ਹੋਇਆ ਹੈ ਜਿਵੇਂ ਕਿ ਜਦੋਂ ਗੋਰਿਆਂ ਦਾ ਰਾਜ ਸੀ ਉਸ ਟਾਈਮ ਪੰਜਾ ਅ ਆਪਣੇ ਸਾਡੇ ਰੋਪੜ ਦੇ ਵਿੱਚ ਚਾਰੇ ਪਾਸੇ ਪਾਣੀ ਪਾਣੀ ਸੀ ਉਸ ਟਾਈਮ ਉਹਨਾਂ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਪਾਣੀ ਨੂੰ ਅਲੱਗ ਅਲੱਗ ਰਾਜਾਂ 'ਚ ਭੇਜਣ ਵਾਸਤੇ ਕੁਛ ਨਹਿਰਾਂ ਬਣਾਈਆਂ ਜਾਂ ਪੱਕੀਆਂ ਨਹਿਰਾਂ ਬਣਾਈਆਂ ਕੁਝ ਕੱਚੀਆਂ ਨਹਿਰਾਂ ਬਣਾਈਆਂ ਸਾਡੇ ਨਾਲ ਇੱਕ ਪਿੰਡ ਸਾਡੇ ਪਿੰਡ ਦੇ ਨਾਲ ਕੱਚੀ ਨਹਿਰ ਪੱਕੀ ਨਹਿਰ ਜਾਂਦੀ ਹੈ ਇੱਕ ਇੱਕ ਕੱਚੀ ਜਾਂਦੀ ਹੈ ਇੱਕ ਪੱਕੀ ਜਾਂਦੀ ਹੈ ਕੱਚੀ ਪੱਕੀ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਬਣਾਉਣ ਦੀ ਤਿਆਰੀ ਕੀਤੀ ਜੋ ਵੀ ਉਹਨਾਂ ਦੇ ਇੰਜੀਨੀਅਰਸ ਬਗੈਰਾ ਸੀਗੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਸਾਡੇ ਨਾਲ ਦੇ ਜਿਹੜੇ ਪਿੰਡ ਸੀਗੇ ਪਿੰਡਾਂ ਦੇ ਲੋਕ ਜੋ ਬੇਰੁਜ਼ਗਾਰ ਸੀ ਉਹਨਾਂ ਨੂੰ ਕੰਮ ਦਿੱਤਾ ਦਿਨ ਪੂਰਾ ਦਿਨ ਲਵਾ ਕੇ ਉਹਨਾਂ ਨੂੰ ਦਿਹਾੜੀ ਦਿੰਦੇ ਸੀ ਰੁਜ਼ਗਾਰ ਮਿਲਿਆ ਔਰ ਪਾਣੀ ਨੂੰ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਬਾਕੀ ਰਾਜਾਂ ਦੇ ਵਿੱਚ ਪਹੁੰਚਾਇਆ ਔਰ ਅੱਜ ਤੱਕ ਉਹ ਨਹਿਰਾਂ ਉਵੀਂ ਚੱਲ ਰਹੀਆਂ ਜਿਹੜੇ ਉਸ ਟਾਈਮ ਗੋਰਿਆਂ ਨੇ ਪੁਲ ਬਣਾਏ ਸੀ ਉਹ ਅੱਜ ਦੇ ਜਿਹੜਾ ਅੱਜ ਦਾ ਸਟਰੱਕਚਰ ਲੁੱਕ ਤਿਆਰ ਕਰਦੇ ਹਾਂ ਇੰਜੀਨੀਅਰ ਕਰਦੇ ਉਹਨਾਂ ਨਾਲੋਂ ਕਿਤੇ ਮਜ਼ਬੂਤ ਔਰ ਅੱਜ ਵੀ ਚੱਲ ਰਹੇ ਹੈ ਰੋਪੜ ਦੇ ਵਿੱਚ ਇੱਕ ਸਤਲੁਜ ਦਰਿਆ ਹੈ ਜਿਸਦੇ ਨਾਲ ਨਾਲ ਇੱਕ ਪੁਲ ਬਣਿਆ ਹੋਇਆ ਹੈ ਜੋ ਗੋਰਿਆਂ ਦੇ ਦੁਆਰਾ ਬਣਾਇਆ ਗਿਆ ਸੀ ਔਰ ਓਹ ਅੱਜ ਵੀ ਮਜਜ਼ਬੂਤ ਪੁਲ ਅੱਜ ਵੀ ਚੱਲ ਰਿਹਾ ਹੈ ਔਰ ਜੋ ਅੱਜ ਕੱਲ੍ਹ ਦੇ ਨਵੇਂ ਪੁਲ ਚਲਦੇ ਆ ਉਹਨਾਂ ਦੇ ਮੁਕਾਬਲੇ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ ਸੋ ਇਸ ਇਹ ਇਸ ਮ ਮਤਲਬ ਸਾਡੇ ਰਾਜ ਦੇ ਵਿੱਚ ਗੋਰਿਆਂ ਨੇ ਚੰਗੇ ਕੰਮ ਵੀ ਬਹੁਤ ਕੀਤੇ ਆ ਔਰ ਮਾੜੇ ਕੰਮ ਵੀ ਬਹੁਤ ਕੀਤੇ ਆ